ਅਸੀਂ ਜਦੋਂ ਵੀ ਇੱਕ ਨਵਾਂ ਡਰਾਈਵਿੰਗ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲੇ ਉਸਦੀ ਇੱਕ ਕਲਪਨਾ ਮਨ 'ਚ ਲਿਆਉਣੀ ਬਹੁਤ ਹੀ ਜ਼ਰੂਰੀ ਹੈ ਜਿਸ ਕਰਕੇ ਅਗਰ ਸਾਡੇ ਮਨ 'ਚ ਕਲਪਨਾ ਜਾਂ ਉਸ ਦੀ ਇੱਕ ਪਿਕਚਰ ਨਹੀਂ ਹੋਏਗੀ ਜਾਂ ਉਹਦੀ ਭਾਵਨਾ ਨਹੀਂ ਹੋਏਗੀ ਤਾਂ ਅਸੀਂ ਕੋਈ ਵੀ ਡਰਾਈਵਿੰਗ ਪ੍ਰੋਜੈਕਟ ਸ਼ੁਰੂ ਹੀ ਨਹੀਂ ਕਰ ਸਕਦੇ ਉਹਨੂੰ ਸ਼ੁਰੂ ਕਰਨ ਲਈ ਸਾਡੇ ਮਨ 'ਚ ਪਿੱਚਰਾਂ ਦੇ ਕਰਕੇ ਅਸੀਂ ਉਸਨੂੰ ਜਾਂ ਅਸੀਂ ਕੀ ਬਣਾਉਣਾ ਚਾਹੁੰਦੇ ਹਾਂ ਉਸਦੀ ਹਿਸਾਬ ਨਾਲ ਹੀ ਸਾਨੂੰ ਸਾਰੀ ਉਹਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ ਜਿੱਦਾਂ ਉਸਦੇ ਲਈ ਪ੍ਰੋਪਰ ਇੱਕ ਸ਼ੀਟ ਵੱਡੀ ਸ਼ੀਟ ਲੈਣੀ ਪੈਂਦੀ ਅਤੇ ਪੈਨਸਲ ਰੇਜਰ ਜੋ ਵੀ ਉਹਦੇ ਨਾਲ ਕਲਰ ਹੋ ਗਏ ਜਿੰਨੀ ਵੀ ਚੀਜ਼ਾਂ ਹੋ ਗਈਆਂ ਉਹਨੂੰ ਪ੍ਰੋਜੈਕਟ ਦੇ ਹਿਸਾਬ ਨਾਲ ਹੀ ਰੱਖਣਾ ਪੈਂਦਾ ਹੈ ਅਤੇ ਮਨ 'ਚ ਅਸੀਂ ਅਗਰ ਇੱਕ ਵਧੀਆ ਪ੍ਰੋਜੈਕਟ ਬਣਾਉਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਨੂੰ ਉਹਦਾ ਡਿਜ਼ਾਇਨ ਰੱਖਣ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਹੈ ਉਸ ਹਿਸਾਬ ਨਾਲ ਸਾਡੇ ਕਲਰ ਡਿਸਾਈਡ ਹੁੰਦੇ ਆ ਅਤੇ ਕਲਰ ਨੂੰ ਅਸੀਂ ਤਾਂ ਹੀ ਉਸ ਪਿਚਰ 'ਚ ਭਰ ਸਕਦੇ ਹਾਂ ਜੇ ਸਾਡੇ ਮਨ 'ਚ ਉਹਦੀ ਭਾਵਨਾ ਅਤੇ ਕਲਪਨਾ ਹੋਏਗੀ ਉਸ ਹਿਸਾਬ ਨਾਲ ਹੀ ਕਲਰ ਉਹਦੇ ਬਹੁਤ ਸੋਹਣੇ ਹੀ ਦ੍ਰਿਸ਼ ਨਜ਼ਰ ਆਉਣਗੇ ਇਸ ਲਈ ਇਹ ਕਲਪਨਾ ਦੀ ਬਹੁਤ ਹੀ ਵੱਡੀ ਭੂਮਿਕਾ ਹੈ ਤੁਹਾਡੇ ਇੱਕ ਨਵੇਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਤਾਂ ਹੀ ਤੁਸੀਂ ਇੱਕ ਵਧੀਆ ਕਰ ਸਕਦੇ ਹੋ